ਯੋਗਾ ਅਭਿਆਸ ਦੇ ਦੌਰਾਨ ਦਿਮਾਗ ਇਕਾਗਰ ਚਿੱਤ ਹੋ ਜਾਂਦਾ ਹੈ ਜਿਸ ਨਾਲ ਵਧੀਆ ਅਤੇ ਪੋਜੀਟਿਵ ਵਿਚਾਰ ਦਿਮਾਗ ਵਿੱਚ ਆਉਂਦੇ ਹਨ ਕੋਈ ਵੀ ਨਕਾਰਾਤਮਕ ਵਿਚਾਰ ਦਿਮਾਗ ਵਿੱਚ ਨਹੀਂ ਆਉਂਦਾ ਸੋਚ ਵਧੀਆ ਹੋ ਜਾਂਦੀ ਹੈ ਅਤੇ ਇਹਨਾਂ ਯੋਗਾ ਸੈਸ਼ਨਾਂ ਦੇ ਦੌਰਾਨ ਤੁਹਾਡਾ ਦਿਮਾਗ ਤਰੋਤਾਜ਼ਾ ਹੋ ਜਾਂਦਾ ਹੈ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਬਾਹਰੀ ਡਰ ਨਹੀਂ ਸਤਾਉਂਦਾ ਯੋਗਾ ਸੈਸ਼ਨਾਂ ਦੇ ਦੌਰਾਨ ਦਿਮਾਗ ਵਿੱਚ ਸਕਾਰਾਤਮਕ ਸੋਚ ਹਾਵੀ ਹੋ ਜਾਂਦੀ ਹੈ ਅਤੇ ਕੁਛ ਕਰ ਗੁਜ਼ਰਨ ਦੀ ਇੱਛਾ ਪ੍ਰਬਲ ਹੋ ਜਾਂਦੀ ਹੈ ਦਿਮਾਗ ਸਹੀ ਦਿਸ਼ਾ ਦੇ ਵਿੱਚ ਜਾਂਦਾ ਹੈ ਅਤੇ ਸਹੀ ਘਟਨਾਵਾਂ ਨੂੰ ਸੋਚਦਾ ਹੈ ਕਿਸੇ ਕਿਸਮ ਦੀ ਨਕਰਾਤਮਕ ਊਰਜਾ ਦਾ ਕੋਈ ਵੀ ਸਥਾਨ ਨਹੀਂ ਹੁੰਦਾ